ਜਿਵੇਂ ਕਿ ਸਾਡੇ ਅੰਮ੍ਰਿਤਸਰ ਗੋਲਡਨ ਟੈਂਪਲ ਲੋਕ ਬਹੁਤ ਦੂਰ ਦੂਰ ਤੋਂ ਮੱਥਾ ਟੇਕਣ ਆਉਂਦੇ ਸਾਡੇ ਗੁਰੂਆਂ ਦੀ ਜਗ੍ਹਾ ਬਾਹਰ ਤੋਂ ਇੰਟਰਨੈਸ਼ਨਲ ਬੰਦੇ ਗੋਰੇ ਸਾਰੇ ਹੀ ਆਪਣੇ ਉਰੇ ਗ ਮੱਥਾ ਟੇਕਣ ਆਉਂਦੇ ਹੈ ਅੰਮ੍ਰਿਤਸਰ ਅਤੇ ਆਪਣੇ ਉਰੇ ਚੰਡੀਗੜ੍ਹ ਇੱਕ ਚਿੜੀਆਘਰ ਹੈ ਲੋਕ ਦੂਰ ਦੂਰ ਤੋਂ ਦੇਖਣ ਆਉਂਦੇ ਐਨੀਮਲਸ ਜਾਨਵਰ ਦੇਖਣ ਆਉਂਦੇ ਵੀ ਕਿਹੜੇ ਕਿਹੜਾ ਜਾਨਵਰ ਹੈ ਉਰੇ ਅਤੇ ਆਪਣੇ ਉਰੇ ਖੜਕੜ ਕਲਾਂ ਨਵਾਂਸ਼ਹਿਰ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ ਖੜਕੜ ਕਲਾਂ ਸ਼ਹੀਦ ਭਗਤ ਸਿੰਘ ਦਾ ਪਿੰਡ ਉੱਥੇ ਜਾਂਦੇ ਹੈ ਉੱਥੋਂ ਆਉਂਦੇ ਆ ਮੱਥਾ ਟੇਕਣ ਉਹਨਾਂ ਦੀ ਸ ਸ਼ਰਧਾਂਜਲੀ ਵਾਸਤੇ ਦੂਰ ਦੂਰ ਤੋਂ ਲੋਕ ਬਹੁਤ ਬਹੁਤ ਦੂਰ ਦੂਰ ਤੋਂ ਆਉਂਦੇ ਆ ਰਾਜਾ ਸਾਹਿਬ ਮਜਾਰਾ ਰਾਜਾ ਜੀ ਦੀ ਜਗ੍ਹਾ ਹੈ ਬਹੁਤ ਹੀ ਬਹੁਤ ਜ਼ਿਆਦਾ ਵਧੀਆ ਆਪਣਾ ਜਲੰਧਰ ਕੋਲ ਨਕੋਦਰ ਹੋ ਗਿਆ ਨਕੋਦਰ ਪੰਜ ਲਾਲਾਂ ਵਾਲੇ ਪੀਰਾਂ ਦੀ ਜਗ੍ਹਾ ਬਾਪੂ ਲਾਲ ਸ਼ਾਹ ਬਾਦਸ਼ਾਹ ਜੀ ਔਰ ਲਾਡੀ ਸ਼ਾਹ ਦੀ ਬਾਬਾ ਵਿੱਕੀ ਸ਼ਾਹ ਬਾਦਸ਼ਾਹ ਦੀ ਜਾਣੀ ਕਿ ਬਹੁਤ ਘੈਂਟ ਘੈਂਟ ਜਗ੍ਹਾ ਹੈ ਬਹੁਤ ਵਧੀਆ ਵਧੀਆ ਜਗ੍ਹਾ ਬਹੁਤ ਲੋਕ ਦੂਰ ਤੋਂ ਲੋਕ ਮੱਥਾ ਟੇਕਣ ਆਉਂਦੇ ਹੈ ਇਸ ਧਾਰਮਿਕ ਸਥਾਨਾਂ ਪਰ ਅਤੇ ਚੰਡੀਗੜ੍ਹ ਅਲਾਂਟੇ ਮੋਲ ਬਹੁਤ ਬੜਾ ਹੈ ਲੋਕ ਘੁੰਮਣ ਵਾਸਤੇ ਜਾਣੀ ਕਿ ਬਹੁਤ ਹੀ ਜ਼ਿਆਦਾ ਆਉਂਦੇ ਹੈ ਸੁਖਨਾ ਲੇਕ ਸਾਰੀ ਚੀਜ਼ਾਂ ਪਰ ਲੋਕ ਘੁੰਮਣ ਘੁੰਮਣ ਆਉਂਦੇ ਹਨ